ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਪੂਜਾ ਸਥਾਨ ਸਥਿਤ ਹਨ ਜਿਵੇਂ ਕਿ ਕਾਲੀ ਮਾਤਾ ਮੰਦਰ ਮੈਂ ਰੋਜ਼ ਕਾਲੀ ਮਾਤਾ ਮੰਦਰ ਜਾਂਦੀ ਹਾਂ ਮੈਂ ਰੋਜ਼ ਸਵੇਰੇ ਪੰਜ ਵਜੇ ਉੱਠ ਕੇ ਮੰਦਰ ਜਾਂਦੀ ਹਾਂ ਉੱਥੇ ਜਾ ਕੇ ਮੈਂ ਪੂਜਾ ਵੀ ਕਰਦੀ ਹਾਂ ਉਸ ਉਹ ਗੁਰਦੁਆਰਾ ਕਾਫੀ ਸਾਲਾਂ ਤੋਂ ਪਟਿਆਲਾ ਸ਼ਹਿਰ ਵਿੱਚ ਹੀ ਸਥਿਤ ਹੈ ਅਤੇ ਇੱਥੇ ਬਹੁਤ ਸਾਰੇ ਲੋਕ ਸਵੇਰੇ ਆਉਂਦੇ ਹਨ ਅਤੇ ਸ਼ਨੀਵਾਰ ਨੂੰ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਇੱਥੇ ਬਹੁਤ ਸਾਰੇ ਉਤਸਵ ਵੀ ਮਨਾਏ ਜਾਂਦੇ ਹਨ ਜਿਵੇਂ ਕਿ ਦਿਵਾਲੀ ਵਗੈਰਾ 'ਤੇ ਵੀ ਇੱਥੇ ਬਹੁਤ ਰੌਣਕਾਂ ਲੱਗਦੀਆਂ ਹਨ ਅਤੇ ਕਈ ਲੋਕ ਜਦੋਂ ਗੁਰਪੁਰਬ ਵਗੈਰਾ ਹੁੰਦਾ ਤਾਂ ਸਿੱਖ ਧਰਮ ਦੇ ਲੋਕ ਵੀ ਦਿਵਾਲੀ ਨੂੰ ਬਹੁਤ ਚੰਗੇ ਤਰੀਕੇ ਨਾਲ ਮਨਾਉਂਦੇ ਹਨ ਉਹ ਉਹ ਗੁਰੂਆਂ ਦੀ ਯਾਦ ਵਿੱਚ ਦਿਵਾਲੀ ਨੂੰ ਮਨਾਉਂਦੇ ਹਨ ਜਿਵੇਂ ਕਿ ਸਿ ਸਿੱਖ ਧਰਮ ਦੇ ਗੁਰੂਆਂ ਗੁਰੂ ਨੇ ਗੁਰੂ ਜੀ ਨੇ ਉਹਨਾਂ ਨੇ ਬੰਦੀਛੋੜ ਦਿਵਸ ਉਹ ਗ ਦਿਵਾਲੀ ਨੂੰ ਬੰਦੀਛੋੜ ਦਿਵਸ ਦੇ ਤਰ੍ਹਾਂ ਮਨਾਉਂਦੇ ਹਨ ਕਿਉਂਕਿ ਉਸ ਦਿਨ ਗੁਰੂ ਜੀ ਨੇ ਬਵੰਜਾਂ ਰਾਜਿਆਂ ਨੂੰ ਕਿਲੇ ਵਿੱਚੋਂ ਛੁਡਵਾਇਆ ਸੀ